ਹੈਲੋ ਮੈਂ ਰਮਨ ਬੋਲ ਰਹੀ ਹਾਂ ਮੈਂ ਕੀ ਮੈਂ ਸਵਿਗੀ 'ਤੇ ਗੱਲ ਕਰ ਰਹੀ ਹਾਂ ਅੱਜ ਮੈਂ ਕਰੀਬ ਦਸ ਵਜੇ ਦੇ ਲਾਗੇ ਪਾਸਤਾ ਅਤੇ ਪੀਜ਼ਾ ਦਾ ਔਡਰ ਬੁੱਕ ਕਰਵਾਇਆ ਸੀ ਜੋ ਕਿ ਕਰੀਬ ਮੈਨੂੰ ਇੱਕ ਵਜੇ ਦੇ ਬਾਅਦ ਮਿਲਿਆ ਅੱਜ ਮੇਰਾ ਅਤੇ ਮੇਰੀ ਪਰਿਵਾਰ ਦਾ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਸੀ ਮੇਰੇ ਅਤੇ ਮੇਰੇ ਭੈਣ ਭਰਾ ਬਹੁਤ ਹੀ ਐਕਸਾਈਟਿਡ ਸਨ ਦੁਪਹਿਰ ਦੇ ਖਾਣੇ ਵਾਸਤੇ ਪਰ ਤੁਹਾਡਾ ਔਡਰ ਟਾਈਮ ਦੇ ਨਾ ਆਉਣ ਕਰਕੇ ਉਹ ਵੀ ਬਹੁਤ ਪ ਬਹੁਤ ਹੀ ਉਦਾਸ ਹੋ ਗਏ ਉਹਨਾਂ ਨੂੰ ਬਿਨਾਂ ਖਾਂਦੇ ਹੀ ਜਾ ਆਪਣੇ ਕੰਮਾਂ 'ਤੇ ਜਾਣਾ ਪਿਆ ਇਸ ਕਰਕੇ ਉਹਨਾਂ ਦਾ ਵੀ ਮੂਡ ਬਹੁਤ ਖ਼ਰਾਬ ਹੋ ਗਿਆ ਮੈਂ ਪਿਛਲੇ ਟਾਈਮ ਵੀ ਤੁਹਾਡੇ ਤੋਂ ਔਡਰ ਬੁੱਕ ਕਰਵਾਇਆ ਸੀ ਜੋ ਕਿ ਮੈਨੂੰ ਬਹੁਤ ਹੀ ਦੇਰ ਨਾਲ ਮਿਲਿਆ ਸੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਨੈਕਸਟ ਟਾਈਮ ਤੋਂ ਇਹ ਆਡਰ ਪਲੀਜ਼ ਕਿਰਪਾ ਪਲੀਜ਼ ਟਾਈਮ ਨਾਲ ਭੇਜ ਦਿਓ ਤਾਂ ਕਿ ਮੈਨੂੰ ਅਤੇ ਮੇਰੀ ਫੈਮਲੀ ਨੂੰ ਇਹ ਦਿੱਕਤ ਜਿਹੜੀ ਫੇਸ ਕਰਨੀ ਨਾ ਪਵੇ ਮੈਨੂੰ ਅਤੇ ਮੇਰੀ ਫੈਮਿਲੀ ਨੂੰ ਇਸ ਤਰ੍ਹਾਂ ਦੇ ਉਦਾਸ ਨਾ ਹੋਣਾ ਪਵੇ ਅਤੇ ਨਾ ਹੀ ਉਹਨਾਂ ਨੂੰ ਭੁੱਖੇ ਕੰਮ 'ਤੇ ਜਾਣਾ ਪਵੇ